ਕਪੂਰਥਲੇ ਜ਼ਿਲ੍ਹੇ ਵਿੱਚ ਕਈ ਇਹੋ ਜਿਹੀਆਂ ਵੇਖਣ ਵਾਸਤੇ ਲੋਕ ਦੂਰ ਦੂਰ ਆਉਂਦੇ ਹਨ ਜਿਵੇਂ ਕਿ ਸਾਇੰਸ ਸੀਟੀ ਸਾਇੰਸ ਸੀਟੀ ਇੱਕ ਅਜਿਹੀ ਜੀ ਅਜਿਹੀ ਜਗ੍ਹਾ ਹੈ ਜੋ ਕਿ ਬੜੀ ਗਿਆਨਪੂਰਵਕ ਹੈ ਅਸ ਬੱਚੇ ਵੀ ਉੱਥੇ ਜਾਂਦੇ ਹਨ ਬਜ਼ੁਰਗ ਜਾਂਦੇ ਹਨ ਹਰ ਕੋਈ ਉੱਥੇ ਜਾ ਸਕਦਾ ਹੈ ਉੱਥੇ ਕਈ ਜਿਹੀਆਂ ਨਈਆਂ ਚੀਜ਼ਾਂ ਹਨ ਜਿਹਨਾਂ ਨੂੰ ਤੁਸੀਂ ਵੇਖ ਸਕਦੇ ਹੋ ਕਈ ਦੁਰਲਭ ਚੀਜ਼ਾਂ ਹਨ ਜਿਵੇਂ ਅਤੇ ਨਾਲ ਜੋ ਡੋਮ ਥੇਟਰ ਬਣਿਆ ਉਹ ਇੱਕ ਬਹੁਤ ਵਧੀਆ ਚੀਜ਼ ਹੈ ਕੰਜਲੀ ਵੇਖਣ ਵੀ ਲੋਕ ਆਉਂਦੇ ਹਨ ਕਿਉਂਕਿ ਕੰਜਲੀ ਇੱਕ ਇੱਕ ਗੰਦੇ ਪਾਣੀ ਦੀ ਨਦੀ ਸੀ ਜਿਸ ਨੂੰ ਕਿ ਸਾਫ ਕਰਵਾਇਆ ਗਿਆ ਬਾਬਾ ਜੀ ਦੁਆਰਾ ਅਤੇ ਉਹ ਇੱਕ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਉਸਦੇ ਆਸ ਪਾਸ ਛੋਟੇ ਛੋਟੇ ਬਾਗ ਹਨ ਲੋਕ ਲੋਕ ਉੱਥੇ ਆਪਣੀ ਚਿੱਤਰਕਾਰੀ ਕਰਦੇ ਹਨ ਲੋਕ ਉੱਥੇ ਫੋਟੋਗ੍ਰਾਫੀ ਕਰਨ ਵੀ ਆਉਂਦੇ ਹਨ ਕਪੂਰਥਲੇ ਵਿੱਚ ਪੰਚ ਮੰਦਿਰ ਵੀ ਹੈ ਜਿਹਨਾਂ ਨੂੰ ਲੋਕ ਦੇਖਣ ਆਉਂਦੇ ਹਨ ਹੋਕੀ ਵੈਨਿਊ ਗੁਰੂ ਨਾਨਕ ਸਟੇਡੀਅਮ ਵੀ ਹੈ ਜਿੱਦਾਂ ਵਾ ਇਸ ਕਰਕੇ ਇਸ ਇਸ ਕਰਕੇ ਕਪੂਰਥਲਾ ਮਸ਼ਹੂਰ ਹੈ ਸਾਇੰਸ ਸੀਟੀ ਇਸ ਦੀ ਇੱਕ ਬੜੀ ਉਪਲਬਧੀ ਹੈ ਅਤੇ ਕੰਜਲੀ ਨਦੀ ਦਾ ਜੋ ਪਾਣੀ ਸਾਫ ਕੀਤਾ ਗਿਆ ਹੈ ਉਸ ਦਾ ਬਹੁਤ ਹੀ ਜ਼ਿਆਦਾ ਲਾਭ ਹੈ ਉਹ ਪਾਣੀ ਹੁਣ ਲੋਕਾਂ ਦੇ ਖੇਤਾਂ ਨੂੰ ਜਾਂਦਾ ਹੈ ਜਿਹੜਾ ਪਾਣੀ ਲੋਕਾਂ ਦੀ ਖੇਤਾਂ ਦੀਆਂ ਫਸਲਾਂ ਨੂੰ ਖਰਾਬ ਕਰਦਾ ਸੀ ਉਹੀ ਪਾਣੀ ਉਹਨਾਂ ਦੀ ਫਸਲਾਂ ਵਾਸਤੇ ਅੰਮ੍ਰਿਤ ਬਣਿਆ ਹੈ ਇਸ ਦਾ ਸਾਰਾ ਸ਼੍ਰੈਅ ਜਿਹੜਾ ਹੈ ਉਹ ਬਾਬੇ ਅਸੀਂ ਤੱਕ ਬਾਬਾ ਜੀ ਨੂੰ ਹੀ ਜਾਂਦਾ ਹੈ ਜਿਹਨਾਂ ਨੇ ਕਿ ਆਪਣੀ ਅਣਥੱਕ ਮਿਹਨਤ ਦੇ ਨਾਲ ਕੰਜਲੀ ਨਦੀ ਨੂੰ ਸਾਫ ਕਰਾ ਕੇ ਲੋਕਾਂ ਦੀ ਭਲਾਈ ਦੇ ਲਈ ਯੂਜ਼ ਕੀਤਾ